ਸਾਡੇ ਖੇਤਰ ਵਿੱਚ ਤਕਨੀਕੀ ਸਹਾਇਤਾ ਪ੍ਰਣਾਲੀ ਬਹੁਤ ਹੀ ਵਧੀਆ ਹੈ ਅਸੀਂ ਘਰ ਬੈਠੇ ਕਿਸੇ ਵੀ ਵਿਸ਼ੇ ਲਈ ਆਪਣੀ ਸਹਾਇਤ ਸ਼ਿਕਾਇਤ ਦਰਜ ਕਰਾ ਸਕਦੇ ਹਾਂ ਅੱਜ ਕੱਲ੍ਹ ਦੇ ਤਕਨੀਕੀ ਦੇ ਯੁੱਗ ਵਿੱਚ ਮਨੁੱਖਾਂ ਨੂੰ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਨਾਲ ਹੀ ਉਹ ਆਪਣੀ ਸ਼ਿਕਾਇਤਾਂ ਅਫਸਰਾਂ ਤੱਕ ਬੜੀ ਹੀ ਆਸਾਨੀ ਨਾਲ ਪਹੁੰਚਾ ਸਕਦਾ ਹੈ ਪੁਰਾਣੇ ਸਮਿਆਂ ਦੇ ਵਿੱਚ ਅਫਸਰਾਂ ਦੇ ਦਫਤਰ ਦੇ ਗੇੜੇ ਕੱਢ ਕੇ ਕਈ ਕਈ ਘੰਟੇ ਲਾਈਨਾਂ ਵਿੱਚ ਖੜ੍ਹੇ ਰਹਿ ਕੇ ਆਪਣੀ ਸ਼ਿਕਾਇਤਾਂ ਦਰਜ ਕਰਾਈਆਂ ਜਾਂਦੀਆਂ ਸਨ ਪਰ ਅਜੋਕੇ ਸਮੇਂ ਵਿੱਚ ਇਹ ਸ਼ਿਕਾਇਤਾਂ ਮੋਬਾਈਲ ਦੇ ਰਾਹੀਂ ਇੰਟਰਨੈੱਟ ਦੇ ਨਾਲ ਹੀ ਦਰਜ ਕਰਾਈਆਂ ਜਾ ਸਕਦੀਆਂ ਹਨ ਅੱਜ ਕੱਲ੍ਹ ਚਾਹੇ ਪੁਲਿਸ ਦੀ ਲੋੜ ਪਵੇ ਚਾਹੇ ਐਬੂਲੈਂਸ ਦੀ ਟੈਕਨੋਲਜੀ ਦੇ ਇਸਤੇਮਾਲ ਨਾਲ ਮਨੁੱਖ ਉਹਨਾਂ ਨੂੰ ਆਪਣੀ ਦਿੱਕਤ ਬਾਰੇ ਦੱਸ ਸਕਦਾ ਹੈ ਅਤੇ ਉਹ ਕੁਛ ਹੀ ਮਿੰਟਾਂ ਵਿੱਚ ਸਹਾਇਤਾ ਲਈ ਹਾਜ਼ਰ ਹੋ ਜਾਂਦੇ ਹਨ ਸਮਾਜ ਸਮਰਥਨ ਪ੍ਰਾਪਤ ਕਰਨ ਲਈ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ ਅਤੇ ਵੱਡ ਸਮਾਜ ਸਮਰਥਨ ਪ੍ਰਾਪਤ ਕਰਨ ਲਈ ਵੱਡੇ ਮੁੱਦਿਆਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ ਸੋਸ਼ਲ ਮੀਡੀਆ 'ਤੇ ਵੱਡੇ ਪੈਮਾਨੇ 'ਤੇ ਲੋਕ ਜੁੜੇ ਹੁੰਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਆਪਣੀ ਗੱਲ ਰੱਖਣ ਨਾਲ ਸਮਾਜ ਦਾ ਸਮਰਥਨ ਬਹੁਤ ਹੀ ਜਲਦੀ ਮਿਲ ਜਾਂਦਾ ਹੈ